ਜੋ ਕੈਮੀਕਲ ਕੀਟਨਾਸ਼ਕ ਹਨ ਉਹ ਕਾਫੀ ਮਿੱਟੀ ਦੀ ਜੋ ਉਪਜਾਊ ਸ਼ਕਤੀ ਹੈ ਉਹਨੂੰ ਘਟਾ ਰਹੇ ਹਨ ਹੁਣ ਲੋਕ ਦੇਸੀ ਖਾਦਾਂ ਜੋ ਹੈ ਗੰਡੋਇਆ ਦੀ ਰੇਹ ਜਾਂ ਮੱਝਾਂ ਦੇ ਗੋਹੇ ਦੀ ਰੇਹ ਉਹ ਘੱਟ ਹੀ ਇਸਤੇਮਾਲ ਕਰਦੇ ਹਨ ਅਤੇ ਜਿਹਨਾਂ ਕਰਕੇ ਡਾਇਆ ਯੂਰੀਆ ਅਤੇ ਕੈਮੀਕਲ ਕੀਟਨਾਸ਼ਕ ਦੀ ਜ਼ਿਆਦਾ ਵਰਤੋਂ ਕਰਦੇ ਹਨ ਜੋ ਸਾਡੀ ਸਿਹਤ 'ਤੇ ਤਾਂ ਅਸਰ ਕਰਦੀ ਹੀ ਹਨ ਅਤੇ ਮਿੱਟੀ ਦੀ ਉਪਜਾਊ ਜੋ ਸ਼ਕਤੀ ਹੈ ਉਹਨਾਂ ਨੂੰ ਵੀ ਘਟਾ ਰਹੇ ਹਨ ਅਤੇ ਜਿਨ੍ਹਾਂ ਦਾ ਸਾਡੀ ਸਿਹਤ 'ਤੇ ਅਸਰ ਪੈਂਦਾ ਹੈ ਅਤੇ ਲੋਕ ਪਰਾਲੀ ਨੂੰ ਅੱਗ ਲਾਉਂਦੇ ਹਨ ਜਿਹਦੇ ਕਰਕੇ ਕਾਫੀ ਧੂੰਆਂ ਚੜਨ ਕਰਕੇ ਲੋਕਾਂ ਨੂੰ ਸਾਹ ਲੈਣ ਦੀਆਂ ਦਿੱਕਤਾਂ ਕਾਫੀ ਦਮੇ ਦੀਆਂ ਬਿਮਰੀਆਂ ਵੀ ਫੈਲਦੀਆਂ ਹਨ ਸਾਡੇ ਲੋਕਾਂ ਨੂੰ ਚਾਹੀਦਾ ਹਨ ਚਾਹੀਦਾ ਹੈ ਕਿ ਜੋ ਕੈਮੀਕਲ ਕੀਟਨਾਸ਼ਕ ਹੈ ਉਹਨਾਂ ਦਾ ਇਸਤੇਮਾਲ ਘੱਟ ਕਰਨ 'ਤੇ ਜੋ ਦੇਸੀ ਤੌਰ 'ਤੇ ਰਿਵਾਇਤੀ ਜੋ ਖੇਤੀਬਾੜੀ ਦੇ ਸਾਧਨ ਹਨ ਜੋ ਰਿਵਾਇਤੀ ਤੌਰ 'ਤੇ ਪੁਰਾਣੇ ਬਜ਼ਰੁਗਾਂ ਵੱਲੋਂ ਜਿਵੇਂ ਖੇਤੀ ਕੀਤੀ ਜਾਂਦੀ ਸੀ ਉਸ ਤਰ੍ਹਾਂ ਖੇਤੀ ਕਰਨ ਤਾਂ ਜੋ ਅਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕੇ ਅਤੇ ਜੋ ਝੋਨੇ ਦੀ ਖੇਤੀ ਕਰਦੇ ਹਨ ਜਿਹਦੇ ਕਰਕੇ ਧਰਤੀ ਹੇਠਲਾ ਪਾਣੀ ਵੀ ਘੱਟਦਾ ਹੈ ਅਤੇ ਉਸ ਦੀ ਜਗ੍ਹਾ ਦਾਲਾਂ ਸਬਜ਼ੀਆਂ ਜਾਂ ਹੋਰ ਵੀ ਕਈ ਤਰ੍ਹਾਂ ਦੇ ਜੋ ਸਾਧਨ ਹਨ ਉਹ ਕੀਤੇ ਜਾ ਸਕਦੇ ਹਨ